ਛੇ ਜਨਵਰੀ ਦੋ ਹਜ਼ਾਰ ਪੰਜ ਸੱਤ ਅਗਸਤ ਦੋ ਹਜ਼ਾਰ ਛੇ ਅੱਠ ਮਈ ਦੋ ਹਜ਼ਾਰ ਅੱਠ ਛੇ ਅਗਸਤ ਦੋ ਹਜ਼ਾਰ ਨੌ ਬਾਰ੍ਹਾ ਜਨਵਰੀ ਦੋ ਹਜ਼ਾਰ ਦਸ ਛੇ ਅਗਸਤ ਦੋ ਹਜ਼ਾਰ ਦਸ